ਪੰਜਾਬ ਵਿੱਚ ਖੇਡਾਂ ਲਈ ਮੁੱਖ ਸਹੂਲਤਾਂ ਸਟੇਡੀਅਮ ਅਤੇ ਮੈਦਾਨ ਹਨ ਜਿਵੇਂ ਕਿ ਗੁਰੂ ਨਾਨਕ ਸਟੇਡੀਅਮ ਗੁਰੂ ਗੋਬਿੰਦ ਸਿੰਘ ਸਟੇਡੀਅਮ ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ ਹੋਰ ਵੀ ਕਈ ਸਟੇਡੀਅਮ ਨੇ